ਸਾਡੇ ਪਿੰਡ ਦੀਆਂ ਔਰਤਾਂ ਮਸਾਲੇ ਪੀਸਣ ਲਈ ਇਕੱਠੀਆਂ ਹੁੰਦੀਆਂ ਹਨ ਉਹ ਇੱਕ ਘਰ ਵਿੱਚ ਕਈ ਘਰਾਂ ਦੀਆਂ ਔਰਤਾਂ ਇਕੱਠੀਆਂ ਹੋ ਕੇ ਆਪਣੇ ਆਪਣੇ ਘਰੋਂ ਮਿਰਚਾਂ ਅਤੇ ਹੋਰ ਵੀ ਮਸਾਲੇ ਲੈ ਆਉਂਦੀਆਂ ਹਨ ਅਤੇ ਫਿਰ ਉਹਨਾਂ ਨੂੰ ਸਾਰੇ ਰਲ ਕੇ ਪੀਸਦੇ ਹਨ